ਹੈਲੋ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਪਛਾਣ ਲਿਆ ਗੁਆਂਡੀਆਂ ਨੂੰ ਕੌਣ ਭੁਲਦਾ ਹੁੰਦਾ ਗੁਆਂਢੀ ਗੁਆਂਢੀ ਨੂੰ ਪਛਾਣੀ ਜਾਂਦੇ ਆ ਨਹੀਂ ਨਹੀਂ ਨੰਬਰ ਸੇਵ ਆ ਤੁਹਾਡਾ ਫੋਨ 'ਚ ਹੋਰ ਸੁਣਾਓ ਘਰ ਠੀਕ ਠੀਕ ਆ ਠੀਕ ਆ ਵਧੀਆ ਬਚੇ ਠੰਡ ਤੋਂ ਸਿਹਤਾਂ ਕੈਮ ਆ ਬਸ ਬੈਠੇ ਹਾਂ ਵਿਹਲੇ ਦੱਸੋ ਅੱਛਾ ਅੱਛਾ ਇੰਟਰਲੋਕ ਵਾਲੀ ਗਲੀ ਕੋਈ ਨਹੀਂ ਲਵਾ ਲੈਂਦੇ ਹਾਂ ਆਪਾਂ ਸਾਰੇ ਘਰ ਇਕੱਠੇ ਹੋ ਕੇ ਉਹ ਤਾਂ ਸਾਰਿਆਂ ਨੂੰ ਇਕੱਠੇ ਕਰਕੇ ਰਾਏ ਕਰ ਲਾਵਾਂਗੇ ਭਈ ਆਹ ਗੱਲ ਹੈਗੀ ਆ ਗਲੀ ਪੱਕੀ ਕਰਾਉਣੀ ਆ ਆਪਾਂ ਸਾਰਿਆਂ ਦਾ ਫ਼ਾਇਦਾ ਹੀ ਇਹਦੇ 'ਚ ਮੀਂਹ ਆ ਮੀਂਹ ਆਉਂਦਾ ਉਦੋਂ ਸਾਰਾ ਹੀ ਖ਼ਰਾਬ ਹੁੰਦੇ ਆ ਬੱਚਿਆਂ ਦਾ ਲੰਘਣਾ ਔਖਾ ਵੱਡੇ ਬਜ਼ੁਰਗਾਂ ਦਾ ਲੰਘਣਾ ਵੀ ਔਖਾ ਟੋਏ ਟਿੱਬੇ ਬਣੇ ਪਏ ਆ ਸਾਰੇ ਨਵੀਂ ਗਲੀ ਬਣ ਜਾਉਗੀ ਵਹੀਕਲ ਵੀ ਲੰਘਣੇ ਸੌਖੇ ਆ ਗੱਡੀਆਂ ਗੁੱਡੀਆਂ ਮੋਟਰਸੈਕਲ ਸੀਵਰੇਜ ਓ ਹਾਂ ਇਹ ਤਾਂ ਹੈ ਨਾਲੇ ਆਪਣੇ ਲੰਘਣਾ ਕਰਨਾ ਸੌਖਾ ਹਾਂ ਮਿਸਤਰੀ ਨੂੰ ਬੁਲਾ ਲੈਂਦੇ ਆਪਾਂ ਉਹਨੂੰ ਪੁੱਛ ਲੈਂਦੇ ਹਾਂ ਵੀ ਕਿੰਨਾ ਕੁ ਖਰਚਾ ਬਣਦਾ ਹੈਗਾ ਉਸ ਹਿਸਾਬ ਨਾਲ ਸਾਰੇ ਘਰਾਂ ਨੂੰ ਕਿਸੇ ਨੂੰ ਚਾਰ ਚਾਰ ਪੰਜ ਪੰਜ ਸੌ ਜਿੰਨਾ ਆਊਗਾ ਉਨਾ ਉਨਾ ਲਗਾ ਕੇ ਅਤੇ ਗਲੀ ਬਣਵਾ ਲਾਵਾਂਗੇ ਆਪਾਂ ਨਹੀਂ ਮੇਰੀ ਨਿਗ੍ਹਾ 'ਚ ਤਾਂ ਹੈ ਨਹੀਂ ਕੋਈ ਤੁਸੀਂ ਵੇਖ ਲਿਓ ਕੋਈ ਹੋਇਆ ਤਾਂ ਵਧੀਆ ਕੰਮ ਕਰਨ ਵਾਲਾ ਕੋਈ ਨਹੀਂ ਪੁੱਛ ਲਵਾਂਗੇ ਉਹਨਾਂ ਨੂੰ ਕਰ ਲਵਾਂਗੇ ਗੱਲ ਹਾਂ ਹਾਂ ਹਾਂ ਨਹੀਂ ਕੋਈ ਨਹੀਂ ਆਪਾਂ ਰਲ ਮਿਲ ਕੇ ਕਰ ਲਵਾਂਗੇ ਸਾਰੇ ਇਹ 'ਚ ਆਪਣੇ ਫ਼ਾਇਦਾ ਅ ਗਲੀ ਬਣ ਜਉਗੀ ਲਾਂਘਾ ਟਾਪਾ ਸੌਖਾ ਬਾਕੀ ਆਪਣੇ ਜਗ੍ਹਾ ਦੀ ਵੀ ਕੀਮਤ ਵਧੂਗੀ ਉਹਦੇ ਨਾਲ ਅਗਲਾ ਕਹਿ ਦਿੰਦਾ ਗਲੀ ਵਧੀਆ ਬਣੀ ਆ ਭਲਕੇ ਮਕਾਨ ਹੀ ਵੇਚਣਾ ਕਰਨਾ ਪੈ ਜਾਂਦਾ ਰੇਟ ਚੰਗਾ ਮਿਲ ਜਾਂਦਾ

ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਕਰ ਲਵਾਂਗੇ ਠੀਕ ਆ ਜੀ ਠੀਕ ਆ